ਮੈਂ ਪਟਿਆਲਾ ਜ਼ਿਲ੍ਹੇ ਦੇ ਸਤਰਾਣਾ ਇਲਾਕੇ ਤੋਂ ਬੋਲ ਰਹੀ ਹਾਂ ਮੈਂ ਤੁਹਾਡੇ ਡਿਲੀਵਰੀ ਬੋਆਏ ਬਾਰੇ ਕੁਛ ਸ਼ਿਕਾਇਤ ਕਰਨੀ ਚਾਹੁੰਦੀ ਹਾਂ ਮੈਂ ਦੋ ਘੰਟੇ ਪਹਿਲਾਂ ਤੁਹਾਡੀ ਕੰਪਨੀ ਤੋਂ ਆਰਡਰ ਕੀਤਾ ਸੀ ਜੋ ਕਿ ਇੱਕ ਘੰਟੇ ਵਿੱਚ ਪਹੁੰਚ ਜਾਂਦਾ ਹੈ ਭਾਵੇਂ ਕਿੰਨੀ ਕੁ ਵੀ ਟਰੈਫਿਕ ਹੋਵੇ ਕਿਉਂਕਿ ਸਿਰਫ ਮੇਰੇ ਘਰ ਤੋਂ ਪੰਦਰਾਂ ਕਿਲੋਮੀਟਰ ਹੈ ਪਰ ਫਿਰ ਵੀ ਉਹ ਦੋ ਘੰਟੇ ਬਾਅਦ ਪਹੁੰਚਿਆ ਜੋ ਮੈਂ ਸਮਾਨ ਮੰਗਵਾਇਆ ਸੀ ਉਹ ਵੀ ਠੰਢਾ ਹੋ ਚੁੱਕਾ ਸੀ ਪਰ ਜਦੋਂ ਮੈਂ ਤੁਹਾਡੇ ਡਿਲੀਵਰੀ ਬੋਆਏ ਨੂੰ ਕਾਰਨ ਪੁੱਛਿਆ ਤਾਂ ਉਹ ਮੇਰੇ ਨਾਲ ਗਾਲੀ ਗਲੋਚ ਗਲ ਹੀ ਪੈ ਗਿਆ ਉਹ ਕਹਿਣ ਲੱਗਾ ਅਸੀਂ ਆਪਦਾ ਕੰਮ ਇਮਾਨਦਾਰੀ ਨਾਲ ਕਰਦੇ ਹਾਂ ਤੁਸੀਂ ਸਾਡੇ ਗਲ ਪੈ ਜਾਂਦੇ ਹੋ ਰਸਤੇ ਵਿੱਚ ਬਹੁਤ ਭੀੜ ਸੀ ਆਵਾਜਾਈ ਜ਼ਿਆਦਾ ਹੋਣ ਕਾਰਨ ਨਹੀਂ ਪਹੁੰਚ ਸਕਿਆ ਜੇ ਮੈਂ ਉਸਨੂੰ ਕਿਹਾ ਕਿ ਫਿਰ ਵੀ ਤੁਸੀਂ ਘੰਟੇ ਵਿੱਚ ਪਹੁੰਚ ਸਕਦੇ ਸੀ ਪਰ ਉਹ ਗਾਲੀ ਗਲੋਚ 'ਤੇ ਆ ਗਿਆ ਮੈਂ ਉਹਦਾ ਨੰਬਰ ਅਤੇ ਨਾਂ ਤੁਹਾਡ ਤੁਹਾਨੂੰ ਵਟਸਐੱਪ ਕਰ ਰਹੀ ਹਾਂ ਕਿਰਪਾ ਕਰਕੇ ਉਹਦੇ ਖਿਲਾਫ ਯੋਗ ਕਾਰਵਾਈ ਕੀਤੀ ਜਾਵੇ